ਭਾਰਤ ਦੀਆਂ ਬਹੁਤ ਸਾਰੀਆਂ ਪ੍ਰਸਿੱਧ ਖੇਡਾਂ ਹਨ ਉਨ੍ਹਾਂ ਵਿੱਚੋਂ ਕੁਝ ਖੇਡਾਂ ਇਹ ਹਨ ਜੋ ਕਿ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਵੇਂ ਕਿ ਕ੍ਰਿਕਟ ਹੋ ਗਈ ਫੁੱਟਬੋਲ ਕਬੱਡੀ ਚੈਸ ਬੇਸਬੋਲ ਜੈਵਲਿਨ ਥ੍ਰੋਅ ਹੈਮਰ ਥ੍ਰੋਅ ਬਾਸਕਿਟਬੋਲ ਇਹ ਸਾਰੀਆਂ ਮਸ਼ਹੂਰ ਖੇਡਾਂ ਹਨ ਅਤੇ ਦੇਸ਼ ਦਾ ਸਭ ਤੋਂ ਮਸ਼ਹੂਰ ਐਥਲੀਟ ਨੀਰਜ ਚੋਪੜਾ ਹੈ ਜਿਸ ਨੇ ਜੈਵਲਿਨ ਥ੍ਰੋਅ ਵਿੱਚ ਹਿੱਸਾ ਲੈ ਕੇ ਸਾਨੂੰ ਸਾਡੇ ਦੇਸ਼ ਨੂੰ ਭਾਰਤ ਨੂੰ ਇੱਕ ਸੋਨੇ ਦਾ ਤਗਮਾ ਦਿਲਵਾਇਆ ਹੈ ਅਤੇ ਇੱਕ ਹੇਮਾ ਦਾਸ ਵੀ ਹੈ